ਅੱਜ ਕੱਲ੍ਹ ਲੋਕਾਂ ਨੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਨਿਊਜ਼ ਚੈਨਲ ਬਣਾਏ ਜਾ ਰਹੇ ਹਨ ਜਿੱਥੇ ਲੋਕ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਦੇਖ ਸਕਦੇ ਆ ਜ਼ਿਆਦਾਤਰ ਉਹ ਖੇਤੀਬਾੜੀ ਦੀ ਵੀਡੀਓ ਵੀ ਦੇਖ ਸਕਦੇ ਹਾਂ ਅੱਜ ਪੁਰਾਣੇ ਸਮੇਂ ਵਿੱਚ ਲੋਕਾਂ ਕੋਲ ਇੰਨਾਂ ਟਾਈਮ ਨਹੀਂ ਹੁੰਦਾ ਸੀਗਾ ਅਤੇ ਅੱਜ ਕੱਲ੍ਹ ਐਡ ਟੈਕਨੋਲਜੀ ਵੀ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਹੈ ਅਤੇ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਘਰ ਬੈਠੇ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਦੇਖ ਸਕਦੇ ਆ ਨਿਊਜ਼ ਚੈਨਲਾਂ ਤੋਂ ਜ਼ਿਆਦਾਤਰ ਪੰਜਾਬ ਦੇ ਵਿੱਚ ਪੀਟੀਸੀ ਪੰਜਾਬੀ ਚੈਨਲ ਚੱਲਦਾ ਏ ਕਿਉਂਕਿ ਉਹ ਚੈਨਲ ਹਮੇਸ਼ਾਂ ਸੱਚ ਬੋਲਦਾ ਏ ਅਤੇ ਉਹ ਕਿਹੜਾ ਚੈਨਲ ਹੈਗਾ ਪੀਟੀਸੀ ਪੰਜਾਬ ਉਹ ਪੰਜਾਬ ਦੀ ਸਰਕਾਰ ਵੱਲੋਂ ਚਲਾਇਆ ਜਾਂਦਾ ਏ ਅਤੇ ਉਹ ਹਮੇਸ਼ਾਂ ਪੰਜਾਬ ਦੇ ਹੱਕ ਦੀ ਗੱਲਾਂ ਦੀ ਗੱਲ ਕਰਦੇ ਹਨ ਮੈਂ ਵੀ ਕਦੋਂ ਵਿਹਲਾ ਹੁੰਦਾ ਉਸ ਟਾਈਮ ਮੈਂ ਟੀ ਵੀ ਔਨ ਕਰਕੇ ਇਹੇ ਜਿਹੇ ਚੈਨਲਾਂ ਨੂੰ ਦੇਖਦਾ ਏ ਕਿਉਂਕਿ ਇਹ ਬਹੁਤ ਵਧੀਆ ਚੈਨਲ ਹੁੰਦੇ ਹਨ ਅਤੇ ਇਹ ਜਿਹੇ ਚੈਨਲ ਦੇਖ ਕੇ ਮੈਂ ਬਹੁ ਨਵੀਂ ਨਵੀਂ ਚੀਜ਼ਾਂ ਸਿੱਖ ਸਕਦਾ ਏ ਅਤੇ ਨਵੇਂ ਰੂਲਸ ਐਂਡ ਰੈਗੂਲੇਸ਼ਨ ਵੀ ਸਿੱਖ ਸਕਦਾ ਏ ਆਪਾਂ ਨੂੰ ਟੀ ਵੀ ਟੀ ਵੀ ਦੀਆਂ ਖਬਰਾਂ ਰੋਜ਼ ਦੇਖਣੀਆਂ ਚਾਹੀਦੀਆਂ ਏ ਕਿਉਂਕਿ ਉਹਦੇ ਨਾਲ ਦ ਬਹੁਤ ਅਲੱਗ ਅਲੱਗ ਫਾਇਦੇ ਹੁੰਦੇ ਆ ਪਰ ਸਾਰਿਆਂ ਤੋਂ ਵੱਡਾ ਫਾਇਦਾ ਇਹ ਹੈ ਕਿ ਆਪਾਂ ਆਪਣੀ ਭਾਸ਼ਾ ਨਾਲ ਜੁੜੇ ਰਹਿੰਦੇ ਹਾਂ ਅਤੇ ਆਪਾਂ ਨੂੰ ਬਹੁਤ ਨਵੀ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆਪਣੇ ਦੇਸ਼ ਬਾਰੇ ਅਤੇ ਆਪਾਂ ਉੱਥੋਂ ਹੋਰ ਵੀ ਨਵੇਂ ਨਵੇਂ ਆਈਡੀਆ ਲੈ ਸਕਦੇ ਹਾਂ ਜਿੰਨਾਂ ਆਪਾਂ ਆਪਣੇ ਦੇਸ਼ ਨੂੰ ਅੱਗੇ ਪਹੁੰਚਾ ਸਕੀਏ ਅੱਜ ਕੱਲ੍ਹ ਵੈਸੇ ਜ਼ਿਆਦਾਤਰ ਲੋਕ ਪੰਜਾਬੀ ਵਿੱਚ ਹੀ ਭਾਸ਼ਾ ਸੁਣਨ ਨੂੰ ਪਸੰਦ ਕਰਦੇ ਆ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਸੁਣੂਗੇ ਐਂ ਅਤੇ ਕੁਛ ਲੋਕ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੁੰਦੇ ਅਤੇ ਜੇ ਜਾ ਜੇਕਰ ਉਹ ਅੰਗਰੇਜ਼ੀ ਅੰਗਰੇਜ਼ੀ ਨਿਊਜ਼ਸ ਸੁਣੂਗੇ ਅਤੇ ਉਹ ਜ ਆਰਾਮ ਨਾਲ ਕੋਈ ਚੀਜ਼ ਸਮਝ ਨਹੀਂ ਸਕਦੇ ਅਤੇ ਉਹਨਾਂ ਨੂੰ ਬਹੁਤ ਟਾਈਮ ਲੱਗੇਗਾ ਜੇ ਪੰਜਾਬ ਦੇ ਲੋਕ ਪੰਜਾਬੀ ਵਿੱਚ ਖਬਰਾਂ ਸੁਣੂਗੇ ਅਤੇ ਉਹ ਗ੍ਰੀਕ ਦੇ ਵਿੱਚ ਸਾਰਾ ਕੁਛ ਸਿੱਖ ਲੂਗੇ ਉਹਨਾਂ ਨੂੰ ਲੋੜ ਨਹੀਂ ਪੈਣੀ ਟਰਾਂਸਲੇਟ ਕਰਨ ਦੀ ਕਿਉਂਕਿ ਉਹਨਾਂ ਦੀ ਪੰਜਾਬੀ ਬਹੁਤ ਵਧੀਆ ਹੁੰਦੀ ਆ ਉਹਦੇ ਕਰਕੇ ਉਹ ਪੰਜਾਬੀ ਆਰਾਮ ਨਾਲ ਬੋਲ ਸਕਦੇ ਸੁਣ ਸਕਦੇ ਆ ਅਤੇ ਜੇ ਉਹਨਾਂ ਨੂੰ ਕੋਈ ਚੀਜ਼ ਸਮਝ ਨਾ ਆਵੇ ਉਹ ਪੰਜਾਬੀ ਦੇ ਵਿੱਚ ਵਾਪਸ ਦੇਖ ਵੀ ਸਕਦੇ ਆ ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜ਼ਿਆਦਾਤਰ ਪੰਜਾਬ ਵਿੱਚ ਪੰਜਾਬੀ ਵਿੱਚ ਨਿਊਜ਼ ਸੁਣਿਆ ਕਰੋ ਕਿਉਂਕਿ ਉਹ ਬਹੁਤ ਵਧੀਆ ਤਰੀਕਿਆਂ ਨਾਲ ਆਪਣੀ ਭਾਸ਼ਾ ਦੇ ਨਾਲ ਕਨੈਕਟ ਰਹਿਣ ਲੀਏ ਅਤੇ ਏ ਕਿ ਜੇ ਪੰਜਾਬੀ ਵਿੱਚ ਖਬਰਾਂ ਸੁਣੂਗੇ ਅਤੇ ਉਹ ਨਵੇਂ ਨਵੇਂ ਸ਼ਬਦ ਸਿੱਖ ਸਕਦੇ ਆ